ਮੈਂ ਆਪਣੇ ਸਮੇਂ ਵਿੱਚ ਅਧਿਆਪਕ ਤੋਂ ਬਹੁਤ ਹੀ ਵਧੀਆ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਨੇ ਵੀ ਬਹੁਤ ਹੀ ਸਾਰਾ ਵਧੀਆ ਸਹਿਯੋਗ ਦਿੱਤਾ ਜਿਵੇਂ ਕਿ ਸਹਿਯੋਗ ਦੇ ਤੌਰ 'ਤੇ ਮੈਨੂੰ ਉਹਨਾਂ ਨੇ ਆਪਣੇ ਮਿਊਜ਼ਿਕ ਕਲਚਰ ਬਾਰੇ ਦੱਸਿਆ ਅਤੇ ਉਹਨਾਂ ਦੇ ਬਹੁਤ ਹੀ ਸਾਰੀ ਜਾਣਕਾਰੀ ਪ੍ਰਾਪਤ ਪ੍ਰਾਪਤ ਮਿਲੀ ਮੈਨੂੰ ਜਿਵੇਂ ਕਿ ਸਿੰਗਿੰਗ ਵਗੈਰਾ ਗਾਉਣ ਵਿੱਚ ਮਦਦ ਮਿਲੀ ਉਹਨਾਂ ਦੇ ਸਵਰ ਸੁਰ ਸਿੱਖੇ ਹੋਏ ਮੈਨੂੰ ਅੱਗੇ ਤੱਕ ਪ੍ਰੇਰਿਤ ਕੀਤਾ ਉਸ ਸੁਰ ਦੇ ਅਕੋਰਡਿੰਗ ਮੈਂ ਕੁਛ ਗਾਣ ਗਾਏ ਉਸ ਤੋਂ ਪ੍ਰਭਾਵਿਤ ਹੋ ਕੇ ਮੈਂ ਆਪਣੀ ਗਾਇਕੀ ਦਾ ਜ਼ਰੀਆ ਬਣੀ ਇਸ ਨਾਲ ਮੈਨੂੰ ਵੀ ਬਹੁਤ ਵਧੀਆ ਸਹਿਯੋਗ ਮਿਲਿਆਂ ਇਸ ਤਰ੍ਹਾਂ ਮੈਨੂੰ ਆਪਣੇ ਅਧਿਆਪਕ ਦਾ ਇੱਕ ਸਹਿਯੋਗ ਪ੍ਰਾਪਤ ਹੋਇਆ ਜੋ ਜੋ ਕਿ ਮੇਰੇ ਅਧਿਆਪਕ ਬਹੁਤ ਹੀ ਮੈਨੂੰ ਪ੍ਰਭਾਵਿਤ ਕੀਤਾ ਉਹਨਾਂ ਦੇ ਸਹਿਯੋਗ ਨੇ